ਹੈਲੋ ਡੋਕਟਰ ਸ਼ਾਰਧਾ ਬੋਲਦੇ ਓ ਜੀ ਮੈਂ ਵੈਭਵ ਬਸ ਵਧੀਆ ਵਧੀਆ ਤੁਸੀਂ ਦੱਸੋ ਘਰ ਬਾਰ ਠੀਕ ਸਭ ਵਧੀਆ ਵਧੀਆ ਮੈਂ ਪੁੱਛਣਾ ਸੀ ਕਲੀਨਿਕ ਕਿੰਨੇ ਵਜੇ ਖੁਲ੍ਹਦਾ ਹੈ ਤੁਹਾਡਾ ਜੀ ਮੈਂ ਕਹਿਣਾ ਸੀਗਾ ਆਉਣਾ ਸੀਗਾ ਥੋੜ੍ਹੀ ਤਬੀਅਤ ਠੀਕ ਨਹੀਂ ਚੱਲਦੀ ਪਈ ਪਿਛਲੇ ਕੁਛ ਦਿਨਾਂ ਤੋਂ ਉਹ ਮੇਰੀ ਸੀ ਨਾਲ ਬੱਚਿਆਂ ਦੀ ਵੀ ਉਹ ਹੀ ਖਾਂਸੀ ਜੁਖਾਮ ਉਹ ਹੀ ਠੀਕ ਨਹੀਂ ਹੋਣ 'ਤੇ ਆ ਰਹਾ ਹੈਗਾ ਮਹੀਨਾ ਹੋ ਗਿਆ ਜੀ ਖਾਂਸੀ ਹੈਗੀ ਹੈ ਥੋੜ੍ਹੀ ਜੁਖਾਮ ਹੈਗਾ ਹੈ ਸਿਰ ਦੁੱਖਦਾ ਹੈ ਬਸ ਜਿੱਦਾਂ ਥੋੜ੍ਹੀ ਦੇਰ ਬਾਹਰ ਰਹਿੰਦੇ ਹਾਂ ਠੀਕ ਹੋ ਜਾਂਦਾ ਘਰ ਆਂਦੇ ਹੈਗਾ ਫਿਰ ਉਹ ਹੀ ਹਾਲ ਹੋ ਜਾਂਦੇ ਅਨ ਸਮਝ ਜਿਹਾ ਨਹੀਂ ਆ ਰਿਹਾ ਥੋੜ੍ਹਾ ਬੱਚਿਆਂ ਦੇ ਇਹੀ ਹਾਲ ਹੈ ਸਕੂਲ ਹੀ ਨਹੀਂ ਜਾ ਪਾ ਰਹੇ ਹੁੰ ਇਹ ਹਿਮਾਚਲ ਹੋ ਕੇ ਆਏ ਸੀਗੇ ਬੱਚੇ ਕਹਿ ਸੀ ਅਸੀਂ ਬਰਫ਼ ਦੇਖਨੀ ਹੈਗੀ ਹੈ ਪਹਾੜਾਂ 'ਚ ਘੁੰਮਣਾ ਬਸ ਉੱਥੇ ਹੋ ਕੇ ਆਏ ਸੀਗੇ ਥੋੜ੍ਹਾ ਜਿਹਾ ਠੀਕ ਹੈ ਹੁਣ ਦੱਸੋ ਫਿਰ ਕਦੋਂ ਆਵਾਂ ਮੈਂ ਤੁਹਾਡੇ ਕੋਲ ਨਾਲ ਬੱਚਿਆਂ ਨੂੰ ਵੀ ਲੈ ਕੇ ਆਉਣਾ ਹੈਗਾ ਬੱਚੇ ਜ਼ਿਆਦਾ ਦੇਰ ਬਹਿ ਨਹੀਂ ਸਕਦੇ ਹਾਂਜੀ ਬੱਚੇ ਟਿਊਸ਼ਨ ਜਾਣਾ ਹੁੰਦਾ ਸੀਗਾ ਪਹਿਲੇ ਟਿਊਸ਼ਨ ਜਾਂਦੇ ਸੀਗੇ ਹੁਣ ਬਿਮਾਰ ਹੈ ਟਿਊਸ਼ਨ ਭੇਜਦੇ ਨਹੀਂ ਅਸੀਂ ਉਨ੍ਹਾਂ ਨੂੰ ਘਰ ਬਿਠਾਇਆ ਹੋਇਆ ਉਹ ਘਰ ਹੀ ਲੱਗੇ ਥੋੜ੍ਹਾ ਬਹੁਤ ਕਰ ਲੈਂਦੇ ਨੇ ਜ਼ਿਆਦੇ ਬਹਿ ਨਹੀਂ ਪਾਉਂਦੇ ਮੈਂ ਕਹਿ ਰਿਆ ਹੈਗਾ ਘਰ ਹੀ ਹੁੰਦੇ ਹਨ ਜਾ ਪੜ੍ਹ ਨਹੀਂ ਪਾ ਰਹੇ ਹੈਗੇ ਤਾਂ ਘਰ ਹੀ ਪੜ੍ਹਾ ਦਿੰਦੇ ਹੈ ਥੋੜ੍ਹਾ ਬਹੁਤ ਬਾਕੀ ਅਰਾਮ ਕਰਦੇ ਹੈਗੇ ਹੈ ਹੁੰ ਜੀ ਤੁਹਾਡੇ ਜੋ ਰਿਸ਼ਤੇਦਾਰ ਹੈਗੇ ਹੈ ਡੋਕਟਰ ਚੱਡਾ ਜੀ ਉਨ੍ਹਾਂ ਕੋਲ ਗਏ ਸੀਗੇ ਆਪਾਂ ਉਨ੍ਹਾਂ ਨੇ ਉਨ੍ਹਾਂ ਨੇ ਨੌਰਮਲ ਖਾਂਸੀ ਦੱਸੀ ਸੀਗੀ ਉਨ੍ਹਾਂ ਕੋਲ ਆਰਾਮ ਨਹੀਂ ਆਇਆ ਉਨ੍ਹਾਂ ਨੇ ਕਿਹਾ ਕਿ ਮੇਰੇ ਰਿਸ਼ਤੇਦਾਰ ਹੈਗੇ ਹੈ ਵਧੀਆ ਡੋਕਟਰ ਹੈਗੇ ਹੈ ਥੋੜ੍ਹੇ ਵੱਡੇ ਹੈਗੇ ਹੈ ਸਮਝ ਹੈਗੀ ਹੋਸਪੀਟਲ ਲੱਗੇ ਹੈ ਤੁਸੀਂ ਉਨ੍ਹਾਂ ਕੋਲ ਚੱਲ ਜੋ ਤੁਹਾਨੂੰ ਕਰਾ ਦੇਗੇ ਇਲਾਜ ਵਧੀਆ ਕਰਦੇ ਹੈਗੇ ਉਹ ਜੀ ਫਿਰ ਤੁਸੀਂ ਥੋੜ੍ਹਾ ਦੱਸ ਦਓ ਅਡਰੈਸ ਅਡਰੁਸ ਕਿੱਥੇ ਆਉਣਾ ਹੈਗਾ ਥੋੜ੍ਹਾ ਸਮਝਾ ਦਓ ਠੀਕ ਹੈ ਜੀ ਆ ਜਾਵਾਂਗਾ